ਮੈਂ ਅੱਜ ਤੁਹਾਨੂੰ ਪਸ਼ੂਆਂ ਬਾਰੇ ਦੱਸਣ ਜਾ ਰਿਹਾ ਹਾਂ ਅਤੇ ਪਸ਼ੂਆਂ ਨੂੰ ਪਹਿਲੇ ਸਵੇਰੇ ਉੱਠ ਕੇ ਉਹਨਾਂ ਨੂੰ ਚੋਣਾ ਹੁੰਦਾ ਧਾਰਾਂ ਕੱਢਣੀਆਂ ਹੁੰਦੀਆਂ ਹਨ ਉਹਨਾਂ ਦੀਆਂ ਅਤੇ ਫਿਰ ਉਹਨਾਂ ਨੂੰ ਪੱਠੇ ਪਾ ਦੇਣੇ ਚਾਹੀਦੇ ਸਨ ਅਤੇ ਉਸ ਤੋਂ ਬਾਅਦ ਜਦ ਉਹ ਪੱਠੇ ਖਾ ਲੈਂਦੇ ਹਨ ਤਾਂ ਉਹਨਾਂ ਨੂੰ ਪਾਣੀ ਪਿਲਾ ਦੇਣਾ ਚਾਹੀਦਾ ਹੈ ਅਤੇ ਫਿਰ ਉਹਨਾਂ ਨੂੰ ਸਾਨੂੰ ਧੁੱਪੇ ਬੰਨ੍ਹ ਦੇਣਾ ਚਾਹੀਦਾ ਹੈ ਸਿਆਲ ਦੇ ਵਿੱਚ ਜੇਕਰ ਗਰਮੀਆਂ ਹੋਣ ਤਾਂ ਉਹਨਾਂ ਨੂੰ ਸ਼ੈੱਡ ਦੇ ਸ਼ੈੱਡ ਦੇ ਨੀਚੇ ਜਾਂ ਡੇਕ ਦੇ ਨੀਚੇ ਬੰਨ੍ਹ ਦੇਣਾ ਚਾਹੀਦਾ ਹੈ ਠੀਕ ਹੈ ਡੇਕ ਦੇ ਨੀਚੇ ਬੰਨ੍ਹ ਦੇਣਾ ਚਾਹੀਦਾ ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਫਿਰ ਅਸੀਂ ਤਿੰਨ ਵਜੇ ਪੱਠੇ ਪਾ ਦਿੰਦੇ ਹਾਂ ਅਤੇ ਫਿਰ ਉਹਨਾਂ ਨੂੰ ਜਦ ਉਹ ਪੱਠੇ ਖਾ ਲੈਂਦੇ ਹਨ ਤਾਂ ਫਿਰ ਉਹਨਾਂ ਨੂੰ ਪਾਣੀ ਪਿਲਾ ਦੇਣਾ ਚਾਹੀਦਾ ਹੈ ਅਤੇ ਫਿਰ ਉਹਨਾਂ ਦਾ ਟਾਇਮ ਹੋ ਜਾਂਦਾ ਹੈ ਛੇ ਵਜੇ ਧਾਰਾਂ ਦਾ ਅਤੇ ਫਿਰ ਉਹਨਾਂ ਦੀਆਂ ਧਾਰਾਂ ਕੱਢਣੀਆਂ ਹੁੰਦੀਆਂ ਹਨ ਫਿਰ ਉਹਨਾਂ ਦੀਆਂ ਧਾਰਾਂ ਕੱਢ ਕੇ ਦੁੱਧ ਡੇਅਰੀ ਵਿੱਚ ਪਾਉਣਾ ਪਾਉਣ ਜਾਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਜੇਕਰ ਕੋਈ ਪਸ਼ੂ ਬਿਮਾਰ ਹੋਵੇ ਤਾਂ ਡਾਕਟਰ ਨੂੰ ਬੁਲਾ ਕੇ ਸਾਨੂੰ ਉਹਨਾਂ ਦੇ ਟੀਕੇ ਲਗਾਉਣੇ ਚਾਹੀਦੇ ਸਨ ਠੀਕ ਹੈ ਟੀਕੇ ਲਵਾਉਣੇ ਚਾਹੀਦੇ ਸਨ ਅਤੇ ਉਸ ਤੋਂ ਬਾਅਦ ਟੀਕੇ ਲਗਾਉਣੇ ਚਾ ਉਸ ਤੋਂ ਬਾਅਦ ਸਾਨੂੰ ਜੇਕਰ ਗਰਮੀਆਂ ਦਾ ਦਿਨ ਹੋਵੇ ਤਾਂ ਰਾਤ ਨੂੰ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੇ ਆਲ਼ੇ ਦੁਆਲ਼ੇ ਸਾਨੂੰ ਤੂੜੀ ਰੱਖ ਕੇ ਅਤੇ ਉਹ ਧੂੰਆਂ ਕਰਨਾ ਚਾਹੀਦਾ ਹੈ ਆਲ਼ੇ ਦੁਆਲ਼ੇ ਇਸ ਕਰਕੇ ਉਹਨਾਂ ਦੇ ਮੱਛਰ ਨਾ ਲੱਗੇ ਤਾਂ ਉਹ ਆਰਾਮ ਨਾਲ਼ ਬਹਿ ਜਾਣ ਉਹ ਵੀ ਉਹਨਾਂ ਦੇ ਵਿੱਚ ਵੀ ਜਾਨ ਹੁੰਦੀ ਹੈ ਸਾਡੇ ਵਰਗੀ ਸਾਡੇ ਵਾਂਗੂੰ